ਹੈਲੋ ਹਾਂਜੀ ਤੁਹਾਡਾ ਮੈਨੂੰ ਭੇਜਿਆ ਆ ਗੀਜ਼ਰ ਜਿਹੜਾ ਮੈਂ ਤੁਹਾਡੇ ਕੋਲੋਂ ਖਰੀਦਿਆ ਉਹ ਮੈਨੂੰ ਬੜਾ ਪਸੰਦ ਆਇਆ ਇੱਕ ਤਾਂ ਉਹ ਚੀਪ ਐਂਡ ਬੈਸਟ ਹੈ ਅਤੇ ਇਕ ਸਰਦੀਆਂ 'ਚ ਠ ਹੱਥ ਇੰਨੇ ਠੰਡੇ ਹੋ ਜਾਂਦੇ ਸੀ ਅ ਭਾਂਡੇ ਮਾਂਜ ਕੇ ਉਹਦਾ ਮੈਨੂੰ ਬੜਾ ਹੀ ਸੁੱਖ ਲੱਗਦਾ ਮੇਰੀ ਬੜੀ ਵਧੀਆ ਚੀਜ਼ ਹੈ ਅਤੇ ਉਹਦੇ ਨਾਲ ਨਹੀਂ ਤਾਂ ਪਹਿਲੋਂ ਮੈਨੂੰ ਬੁਖਾਰ ਜਿਹਾ ਚੜ ਜਾਂਦਾ ਸੀ ਔਰ ਤੁਹਾਡਾ ਮੈਨੂੰ ਵਰਕਿੰਗ ਵੀ ਬਹੁਤ ਅੱਛੀ ਲੱਗੀ ਹੈ ਕਿ ਉਹ ਖੁਦ ਹੀ ਆਪ ਆ ਕੇ ਫਿੱਟ ਕਰ ਗਏ ਨੇ ਅਤੇ ਕੋਈ ਚਾਰਜਿਸ ਵਗੈਰਾ ਨਹੀਂ ਲਿੱਤਾ ਅਤੇ ਵੈਸੇ ਵੀ ਸਸਤਾ ਦਾ ਸਸਤਾ ਹੈ ਔਰ ਇਹ ਦਿਨਾਂ 'ਚ ਤਾਂ ਵੈਸੇ ਵੀ ਇਹਦੀ ਇਮਪੋਰਟੈਂਸ ਬੜੀ ਹੈਗੀ ਸੀ ਅਤੇ ਤੁਸੀਂ ਠੀਕ ਟਾਈਮ 'ਤੇ ਭੇਜ ਵੀ ਦਿੱਤਾ ਅਤੇ ਮੈਨੂੰ ਉਹ ਕਾਫੀ ਅੱਛਾ ਲੱਗਾ ਵਾ ਅਤੇ ਮੈਂ ਹੋਰਾਂ ਨੂੰ ਵੀ ਸੂਜੈਸ ਕਰਾਂਗੀ ਕਿ ਇਹ ਗੀਜ਼ਰ ਖਰੀਦ ਲੈਣ ਅਤੇ ਆਪਣੇ ਹੱਥਾਂ ਨੂੰ ਇੰਨਾ ਠੰਡੇ ਨਾ ਕਰਨ ਅਤੇ ਆਪਣੇ ਆਪ ਨੂੰ ਬਿਮਾਰ ਨਾ ਪਾਉਣ ਕਿਉਂਕਿ ਮੈਨੂੰ ਤੁਹਾਡੀ ਇਹਦੀ ਵਰਕਿੰਗ ਬਹੁਤ ਅੱਛੀ ਲੱਗੀ ਹੈ ਅਤੇ ਮੇਰਾ ਗੀਜ਼ਰ ਬਹੁਤ ਵਧੀਆ ਚੱਲਦਾ ਪਿਆ ਅਤੇ ਮੈਂ ਹੋਰਾਂ ਨੂੰ ਵੀ ਸੁਜੈਸ ਕਰਾਂਗੀ ਕਿ ਉਹ ਤੁਹਾਡੇ ਕੋਲੋਂ ਗੀਜ਼ਰ ਬਾਏ ਕਰਨ